ਪਿਛਲੇ ਦਿਨੀਂ ਮੇਰੇ ਛੋਟੇ ਭਰਾ ਦੇ ਵਿਆਹ ਦੇ ਸੰਬੰਧ ਦੇ ਵਿੱਚ ਜਦੋਂ ਮੈਂ ਕੱਪੜੇ ਖਰੀਦਣ ਦੀ ਸੋਚ ਰਿਹਾ ਸੀ ਤਾਂ ਮੇਰੇ ਮਨ ਵਿੱਚ ਕੱਪੜੇ ਖਰੀਦਣ ਲਈ ਕਮੀਜ਼ ਖਰੀਦਣ ਲਈ ਮਨ ਵਿੱਚ ਬੜੀਆਂ ਹੀ ਦਿਮਾਗ ਵਿੱਚ ਅਲੱਗ ਅਲੱਗ ਵਿਚਾਰ ਘੁੰਮ ਰਹੇ ਸਨ ਕਿਉਂਕਿ ਅੱਜ ਕੱਲ੍ਹ ਬਹੁਤ ਸਾਰਾ ਜ਼ਮਾਨਾ ਆਨਲਾਈਨ ਖਰੀਦਦਾਰੀ 'ਤੇ ਹੀ ਅਧਾਰਿਤ ਹੋ ਗਿਆ ਹੈ ਪਰ ਆਨਲਾਈਨ ਦੀ ਖਰੀਦਾਰੀ ਦੇ ਸੰਬੰਧ ਦੇ ਵਿੱਚ ਮੇਰੇ ਮਨ ਵਿੱਚ ਕੁਝ ਸ਼ੰਕਾਵਾਂ ਵੀ ਸਨ ਕਿ ਕੱਪੜੇ ਦੀ ਕੁਆਲਿਟੀ ਕੱਪੜੇ ਦਾ ਰੰਗ ਕੱਪੜੇ ਦੀ ਮੈਚਿੰਗ ਔਰ ਕੱਪੜੇ ਦੀ ਫਿਟਿੰਗ ਔਰ ਉਸਦੀ ਜੋ ਵਾਪਸੀ ਉਸਦੀ ਕੀਮਤ ਸਬੰਧੀ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸਨ ਅਤੇ ਕੁਝ ਸਵਾਲ ਮੇਰੇ ਮਨ ਵਿੱਚ ਹੋਰ ਵੀ ਆ ਰਹੇ ਸਨ ਕਿ ਮੈਂ ਬਾਜ਼ਾਰ ਜਾਵਾਂ ਉਹ ਤੋਂ ਆਪਣੇ ਮਨ ਪਸੰਦ ਕੱਪੜਾ ਖਰੀਦ ਕੇ ਟੇਲਰ ਤੋਂ ਸਿਲਵਾ ਲੈਂਦਾ ਹਾਂ ਪਰ ਕਿਉਂਕਿ ਵਿਆਹ ਦਾ ਸੀਜਨ ਸੀ ਇਸ ਕਰਕੇ ਟੇਲਰ ਵੱਲੋਂ ਸਾਨੂੰ ਸਮੇਂ ਸਿਰ ਉਸ ਕਮੀਜ਼ ਦੀ ਸਿਲਾਈ ਕੋਟ ਪੈਂਟ ਦੀ ਸਿਲਾਈ ਦੇ ਸਬੰਧ ਵਿੱਚ ਪੱਕੀ ਇਨਫੋਰਮੇਸ਼ਨ ਜਾਂ ਪੱਕੀ ਸੂਚਨਾ ਜਾਂ ਪੱਕਾ ਪ੍ਰੋਮਿਸ ਨਹੀਂ ਕੀਤਾ ਗਿਆ ਕਿ ਉਹ ਦੇ ਪਾਵੇਗਾ ਜਾਂ ਨਹੀਂ ਇਸ ਲਈ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਆ ਰਹੇ ਸਨ ਕਿ ਵਿਚਾਰ ਕੀਤਾ ਕਿ ਚਲੋ ਆਨਲਾਈਨ ਹੀ ਖਰੀਦਦਾਰੀ ਕਰ ਲੇ ਕਰ ਲੈਂਦੇ ਹਾਂ ਦੋ ਪੰਜ ਛੇ ਆਨਲਾਈਨ ਸਾਈਟ ਦੇ ਵਿੱਚ ਮੈਂ ਭਾਲ ਵੀ ਕੀਤੀ ਉਹਦੇ ਵਿੱਚ ਮੈਨੂੰ ਕੁਝ ਕੱਪੜੇ ਪਸੰਦ ਵੀ ਆ ਗਏ ਸੀ ਪਰ ਮਨ ਦੇ ਵਿੱਚ ਫਿਰ ਉਹ ਹੀ ਸਵਾਲ ਕਿ ਇਹ ਤਾਂ ਸਾਰੇ ਫੋਨ ਦੁਆਰਾ ਖਿੱਚੇ ਗਏ ਕਲਰ ਹਨ ਜਦੋਂ ਸਾਹਮਣੇ ਆਏਗਾ ਤਾਂ ਕੀ ਉਹ ਵਾਪਸ ਕਰ ਲੈਣਗੇ ਜਾਂ ਕੀ ਉਹ ਮੇਰੇ ਮਨ ਪਸੰਦ ਹੋਏਗਾ ਕਿਉਂਕਿ ਵਾਪਸੀ ਦੇ ਵੀ ਇੱਕ ਲੰਬੀ ਪ੍ਰਕਿਰਿਆ ਹੈ ਪਹਿਲਾਂ ਤਾਂ ਆਉਣ ਨੂੰ ਦੋ ਦਿਨ ਟਾਈਮ ਲੱਗੇਗਾ ਫਿਰ ਦੋ ਦਿਨ ਬਾਅਦ ਜੇ ਪਸੰਦ ਨਾ ਆਏ ਤਾਂ ਫਿਰ ਵਾਪਸ ਕਰਨ ਨੂੰ ਇਸ ਲਈ ਮਨ ਵਿੱਚ ਬੜੀ ਸ ਦੁਵਿਧਾ ਰਹੀ ਪਰ ਇਸ ਦੁਵਿਧਾ ਨੂੰ ਮੇਰੀ ਬੇਟੀ ਨੇ ਦੂਰ ਕਰ ਦਿੱਤਾ ਉਹਨੇ ਮੈਨੂੰ ਕੁਛ ਬਹੁਤ ਹੀ ਮਸ਼ਹੂਰ ਆਨਲਾਈਨ ਸਾਈਟ ਦੇ ਬਾਰੇ ਦ ਦੱਸਿਆ ਅਤੇ ਜਦੋਂ ਮੈਂ ਆਪਣੇ ਫੋਨ 'ਤੇ ਉਸ ਸਾਈਟਸ ਦਾ ਵਿਜਿਟ ਕੀਤਾ ਤਾਂ ਮੈਨੂੰ ਉਹਨਾਂ ਵਿੱਚੋਂ ਦੋ ਤਿੰਨ ਕਮੀਜਾਂ ਪਸੰਦ ਆ ਗਈਆਂ ਅਤੇ ਜਦੋਂ ਮੈਂ ਮੰਗਾਈਆਂ ਤਾਂ ਉਹ ਮੇਰੀ ਜ਼ਰੂਰਤ ਦੇ ਹਿਸਾਬ ਦੇ ਨਾਲ ਔਰ ਮੇਰੀ ਫਿਟਿੰਗ ਦੇ ਹਿਸਾਬ ਦੇ ਨਾਲ ਉਹ ਬਿਲਕੁਲ ਪਰਫੈਕਟ ਸਨ ਔਰ ਮੈਨੂੰ ਉਸ ਆਨਲਾਈਨ ਤੋਂ ਹੀ ਮੇਰੇ ਮਨ ਪਸੰਦ ਦੀ ਸ਼ੋਪਿੰਗ ਵੀ ਹੋ ਗਈ ਮੇਰੇ ਮਨ ਪਸੰਦ ਦਾ ਕੱਪੜਾ ਵੀ ਮਿਲ ਗਿਆ ਮੇਰੇ ਮਨ ਪਸੰਦ ਦੇ ਰੇਟ ਵੀ ਮਿਲ ਗਏ ਤਾਂ ਇਹ ਜੋ ਅੱਜ ਕੱਲ੍ਹ ਜੋ ਆਨਲਾਈਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਮੈਂ ਇਸ ਤੋਂ ਕਾਫੀ ਸੰਤੁਸ਼ਟ ਹੋਇਆਂ ਜੀ